ਸਾਡੇ ਰੋਪੜ ਵਿੱਚ ਬਹੁਤ ਸਾਰੇ ਮੂਵੀ ਥੇਟਰ ਹਨ ਜਿੱਥੇ ਅਸੀਂ ਜਾਂਦੇ ਰਹਿੰਦੇ ਹਨ ਇੱਥੇ ਕਲਿਆਣ ਸਿਨੇਮਾ ਸਮਾਰਟ ਸਿਨੇਮਾ ਆਦਿ ਹਨ ਇੱਥੇ ਬਹੁਤ ਹੀ ਸਾਰੀਆਂ ਚੀਜ਼ਾਂ ਹਨ ਟੀ ਇੱਕ ਬੰਦੇ ਦੀ ਟਿਕਟ ਦੋ ਸੌ ਰੁਪਏ ਹਨ ਅਤੇ ਬਹੁਤ ਹੀ ਵਧੀਆ ਮਨੋਰੰਜਨ ਕਰਦੇ ਹਨ ਕੁਰਸੀਆਂ ਆਦਿ ਲੱਗੀਆਂ ਹੋਈਆਂ ਹਨ ਅਤੇ ਉਸ ਮਾ ਬਹੁਤ ਹੀ ਵਧੀਆ ਤਰੀਕੇ ਨਾਲ ਅਸੀਂ ਉਸਨੂੰ ਸਵਾਰੀ ਕਰਦੇ ਹਨ ਅਤੇ ਚੰਡੀਗੜ੍ਹ ਵਿੱਚ ਵੀ ਬਹੁਤ ਸਾਰੀਆਂ ਸਿਨੇਮਾ ਮੋਲ ਹਨ ਅਤੇ ਜਿੱਥੇ ਅਸੀਂ ਜਾਂਦੇ ਹਨ ਅਤੇ ਆਨੰਦ ਲੈਂਦੇ ਹਨ ਟਿਕਟ ਮਹਿੰਗੀ ਹੁੰਦੀ ਹਨ ਪੰਜ ਪੰਜ ਸੌ ਰੁਪਏ ਅਤੇ ਉਸ ਵਿੱਚ ਅਸੀਂ ਖਾਣ ਪੀਣ ਦਾ ਵੀ ਆਨੰਦ ਲੈ ਸਕਦੇ ਹਨ ਹਰ ਇੱਕ ਚੀਜ਼ ਦਾ